ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਰਮਨਦੀਪ ਤੁਹਾਡੇ ਸਾਰਿਆਂ ਦੇ ਨਾਲ ਆਪਣੀ ਹੱਡਬੀਤੀ ਗੱਲ ਸ਼ੇਅਰ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਮੈਂ ਪਿਛਲੇ ਸਾਲ ਦੌੜ ਦੇ ਵਿੱਚ ਪਾਰਟੀਸਪੇਟ ਕੀਤਾ ਸੀਗਾ ਜਿਹੜੇ ਸਾਡੇ ਕਾਲਜ ਦੇ ਵਿੱਚ ਕਰਵਾਈਆਂ ਗਈਆਂ ਸੀ ਸਾਡੇ ਪ੍ਰਿੰਸੀਪਲ ਸਾਹਿਬ ਵੱਲੋਂ ਉਹ ਸਪੋਰਟਸ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਓਦਾਂ ਵੀ ਉਹ ਸਲੈਕਟ ਹੋਏ ਦੇ ਆ ਅਤੇ ਉਹ ਓਦਾਂ ਵੀ ਸਪੋਰਟਸ ਦੇ ਨਾਲ ਬਹੁਤ ਜੁੜੇ ਹੋਏ ਆ ਅਤੇ ਉਹਨਾਂ ਨੇ ਜਦੋਂ ਦੌੜਾ ਕਰਵਾਈਆਂ ਅਤੇ ਮੈਂ ਦੌੜ ਦੇ ਵਿੱਚ ਸਪੈਸ਼ਲੀ ਬਹੁਤ ਹੀ ਵਧੀਆ ਸੀਗਾ ਅਤੇ ਮੈਂ ਬਹੁਤ ਹੀ ਖੁਸ਼ੀ ਦੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਮੈਂ ਅਤੇ ਮੇਰੇ ਨਾਲ ਦੇ ਗਰੁੱਪ ਵਾਲੇ ਜਿਹੜੇ ਸਾਥੀ ਸੀਗੇ ਸਾਰੇ ਜਣਿਆਂ ਨੇ ਆਪਾਂ ਬਹੁਤ ਹੀ ਵਧੀਆ ਪਾਰਟੀਸਪੇਟ ਕੀਤਾ ਦੌੜ ਲਾਈ ਅਤੇ ਸਾਡੇ ਜਿਹੜੇ ਕੋਚ ਸਾਹਿਬ ਵੀ ਸੀਗੇ ਰਣਜੀਤ ਬਾਵਾ ਜੀ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਟ੍ਰੇਨਿੰਗ ਦਿੱਤੀ ਜਿੱਥੇ ਜਿੱਥੇ ਜਿਸ ਜਿਸ ਤਰ੍ਹਾਂ ਦੀ ਦੌੜ ਪਈ ਆ ਹਰ ਇੱਕ ਸੰਭਾਵਿਕ ਮਦਦ ਜਿਹੜੀ ਆ ਉਹਨਾਂ ਨੇ ਸਾਡੀ ਕੀਤੀ ਆ ਮਤਲਬ ਕਿ ਜਿੱਥੇ ਪਾਣੀ ਦੀ ਲੋੜ ਪਈ ਆ ਪਾਣੀ ਆ ਜਿੱਥੇ ਉਹ ਕਦੀ ਉਹਨਾਂ ਨੇ ਸਾਨੂੰ ਟਾਇਰ ਪਾ ਕੇ ਦੌੜਾਇਆ ਵਾ ਕਦੀ ਧੁੱਪ ਨਹੀਂ ਵੇਖੀ ਛਾਂ ਨਹੀਂ ਵੇਖੀ ਜਦੋਂ ਦੌੜਨਾ ਵਾ ਉਦੋਂ ਸਿਰਫ ਦੌੜਨਾ ਹੀ ਆ ਉਹਨਾਂ ਨੇ ਬਹੁਤ ਹੀ ਵਧੀਆ ਸਾਨੂੰ ਪ੍ਰੈਕਟਿਸ ਕਰਵਾਈ ਆ ਉਹਨਾਂ ਦੀ ਮਿਹਨਤ ਸਦਕਾ ਅਸੀਂ ਜਿਹੜਾ ਵਾ ਰਿਲੇਅ ਦੌੜ ਦੇ ਵਿੱਚ ਜਿਹੜਾ ਵਾ ਉਹ ਪਹਿਲੇ ਨੰਬਰ 'ਤੇ ਸਫਲ ਹੋਏ ਜਦੋਂ ਰਿਲੇਅ ਦੌੜ ਹੋਈ ਆ ਉਹਦੇ ਵਿੱਚ ਚਾਰ ਜਣੇ ਹੁੰਦੇ ਸੀਗੇ ਚਾਰਾਂ ਜਣਿਆਂ ਦੇ ਵਿੱਚੋਂ ਜਿਹੜਾ ਪਹਿਲਾ ਜਣਾ ਸੀਗਾ ਉਹ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਇੱਕ ਰਾਊਂਡ ਕੱਟ ਕੇ ਆਉਂਦਾ ਵਾ ਜਿਹੜੇ ਚਾਰ ਸੌ ਮੀਟਰ ਦੀ ਗਰਾਉਂਡ ਵਾਲੇ ਵਿੱਚ ਇੱਕ ਰਾਊਂਡ ਕੱਟ ਕੇ ਆਉਂਦਾ ਵਾ ਅਤੇ ਦੂਸਰਾ ਜਣਾ ਜਦੋਂ ਤੱਕ ਉਹ ਹੱਥ ਵਿੱਚ ਦੂਸਰਾ ਜਣੇ ਨੂੰ ਰੋਡ ਨਹੀਂ ਹੈਗਾ ਫੜਾਉਂਦਾ ਉਦੋਂ ਤੱਕ ਦੂਸਰਾ ਜਣਾ ਦੌੜ ਨਹੀਂ ਪਾਉਂਦਾ ਜਿੱਦਾਂ ਹੀ ਉਹ ਪਹਿਲਾ ਜਣਾ ਦੂਸਰੇ ਜਣੇ ਨੂੰ ਰੋਡ ਫੜਾਈ ਆ ਨਾਲ ਦੂਸਰਾ ਜਣਾ ਦੌੜ ਕੇ ਜਿਹੜਾ ਵਾ ਉਹ ਅਗਲੇ ਚੱਕਰ ਦੇ ਲਈ ਰੈਡੀ ਹੋ ਜਾਂਦਾ ਵਾ ਅਤੇ ਨਾਲ ਹੀ ਤੀਸਰਾ ਇਸੇ ਤਰ੍ਹਾਂ ਨਾਲ ਹੀ ਚੌਥਾ ਚੌਥਾ ਜਣਾ ਚੌਥਾ ਚੱਕਰ ਜਿਹੜਾ ਵਾ ਉਹ ਲਗਾ ਕੇ ਜਿਹੜਾ ਵਾ ਆਪਾਂ ਦੌੜ ਨੂੰ ਜਿਹੜਾ ਵਾ ਉਹ ਤਿੰਨ ਮਿੰਟ ਅਤੇ ਪਚਵੰਜਾ ਸੈਕਿੰਡ ਦੇ ਵਿੱਚ ਕੰਪਲੀਟ ਕੀਤਾ ਜਿਹੜੀ ਕਿ ਸੋਲਾ ਸੌ ਮੀਟਰ ਦੀ ਦੌੜ ਹੈਗੀ ਆ ਬਹੁਤ ਹੀ ਜ਼ਬਰਦਸਤ ਦੌੜ ਇਹਦੇ ਪ੍ਰੈਕਟਿਸ ਕੀਤੀ ਗਈ ਅਤੇ ਮੈਂ ਆਪਣੇ ਕੋਚ ਸਾਹਿਬ ਦਾ ਬਹੁਤ ਹੀ ਧੰਨਵਾਦੀ ਹਾਂ